ਤੁਹਾਡੇ ਅਨੁਸਾਰ ਭੰਗੜਾ ਐਰੋਬੈਕਸ ਬਾਰੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਗਲਤ ਧਾਰਨਾਵਾਂ ਕੀ ਹਨ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਹੱਲ ਕਰੋਗੇ ਭੰਗੜਾ ਪਾਉਣ ਲੱਗਿਆ ਸਰੀਰ ਦੇ ਸਾਰੇ ਅੰਗ ਹਿਲਾਏ ਜਾਂਦੇ ਹਨ ਜਿਸ ਨਾਲ ਕੁਝ ਅੰਗ ਖ਼ਰਾਬ ਹੋ ਜਾਂਦੇ ਹਨ ਇਹ ਧਾਰਨਾ ਲੋਕਾਂ ਵਿੱਚ ਹੁੰਦੀ ਹੈ ਭੰਗੜਾ ਐਰੋਵੈਕਸ ਨਾਲ ਲੜਕੀਆਂ ਨੂੰ ਤਕਲੀਫ ਹੁੰਦੀ ਹੈ ਇਹ ਗਲਤ ਧਾਰਨਾ ਵੀ ਲੋਕਾਂ ਵਿੱਚ ਪਾਈ ਜਾਂਦੀ ਹੈ ਅੱਜ ਕੱਲ੍ਹ ਸਮਾਜ ਵਿੱਚ ਯੋਗਾ ਨੂੰ ਤਰਜੀਹ ਦਿਓ ਜਾਂਦੀ ਹੈ ਲੋਕਾਂ ਵਿੱਚ ਬਦਲਣੀ ਚਾਹੀਦੀ ਹੈ ਭੰਗੜਾ ਸਰੀਰ ਨੂੰ ਤਾਕਤਵਾਰ ਬਣਾਉਂਦਾ ਹੈ ਜੋ ਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਲੋੜ ਹੈ ਅਤੇ ਭੰਗੜਾ ਅਤੇ ਯੋਗਾ ਸਾਡੀ ਸਿਹਤ ਵਾਸਤੇ ਇਹ ਫਾਇਦੇਮੰਦ ਹੈ ਲੋਕਾਂ ਦੇ ਦਿਮਾਗ ਵਿੱਚੋਂ ਇਹ ਧਾਰਨਾ ਕੱਢਣੀ ਚਾਹੀਦੀ ਹੈ ਕਿ ਇਹਦੇ ਨਾਲ ਕੁਛ ਸਾਨੂੰ ਨੁਕਸਾਨ ਹੁੰਦਾ ਹੈ ਜਦੋਂ ਕਿ ਭੰਗੜਾ ਸਾਡੇ ਸਰੀਰ ਵਾਸਤੇ ਜੋਗਾ ਸਾਡੇ ਸਰੀਰ ਵਾਸਤੇ ਜੋ ਕਿ ਕਈ ਅੰਗਾਂ ਨੂੰ ਖੋਲ੍ਹਦਾ ਹੈ ਅਤੇ ਅਸੀਂ ਕਈ ਬਿਮਾਰੀਆਂ ਤੋਂ ਰਹਿਤ ਹੁੰਦੇ ਹਾਂ ਅਤੇ ਇਹਦੇ ਨਾਲ ਸਾਡਾ ਸਰੀਰ ਚੁਸਤ ਫੁਰਤ ਰਹਿੰਦਾ ਹੈ ਇਹ ਧਾਰਨਾ ਗਲਤ ਕੱਢਣੀ ਚਾਹੀਦੀ ਹੈ